ਅੱਜ ਅੱਜ ਕੱਲ੍ਹ ਹਰ ਚੀਜ਼ ਤਕਨਾਲੋਜੀ 'ਤੇ ਨਿਰਭਰ ਕਰਦੀ ਹੈ ਤਕਨਾਲੋਜੀ ਤੋਂ ਬਿਨ੍ਹਾਂ ਮਨੁੱਖ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦਾ ਅਨੁਮਾਨ ਵੀ ਨਹੀਂ ਲਗਾ ਸਕਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤਕਨਾਲੋਜੀ ਨਾਲ ਹੀ ਸੰਬੰਧਿਤ ਹੋਈਆਂ ਸਨ ਹਨ ਜਿਵੇਂ ਕਿ ਜਿਵੇਂ ਕਿ ਇਨਸਾਨਾਂ ਦਾ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਨਾ ਇਸ ਲਈ ਇਸ ਵਿੱਚ ਇਸ ਵਿੱਚ ਮਨੁੱਖ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਸੀ ਕਿ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਸਾਨੀ ਨਾਲ਼ ਜਾ ਸਕਣ ਇਸ ਲਈ ਤਕਨਾਲੋਜੀ ਨੇ ਇੱਕ ਨਵੀਂ ਖੋਜ ਕੀਤੀ ਅਤੇ ਕਾਰਾਂ ਅਤੇ ਸਕੂਟਰਾਂ ਦੀ ਖੋਜ ਹੋਈ ਇਸ ਤੋਂ ਬਾਅਦ ਅੱਜ ਹਰ ਕਿਸੇ ਕੋਲ ਆਪਣੀ ਇੱਕ ਕਾਰ ਬਾਈਕ ਹਰ ਕੋਈ ਚੀਜ਼ ਹੈ ਜਿਸ ਨਾਲ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਰਾਮ ਨਾਲ ਜਾ ਸਕਦੇ ਹਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਸ ਵਿੱਚ ਤਕਨਾਲੋਜੀ ਨੇ ਮਨੁੱਖੀ ਸਹਿਯੋਗ ਨੂੰ ਬਹੁਤ ਹੀ ਘਟਾ ਦਿੱਤਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਆਸਾਨੀ ਨਾਲ ਕਰ ਦਿੱਤੀ ਹੈ ਜਿਵੇਂ ਕਿ ਤਕਨਾਲੋਜੀ ਨਾਲ਼ ਸੰਬੰਧਿਤ ਖੋਜ ਕੱਪੜੇ ਧੋਣ ਵਾਲੀ ਮਸ਼ੀਨ ਇਸ ਰਾਹੀਂ ਘਰ ਇਸ ਰਾਹੀਂ ਘਰੇਲੂ ਔਰਤਾਂ ਨੂੰ ਬਹੁਤ ਹੀ ਆਸਾਨੀ ਹੋਈ ਹੈ ਕਿਉਂਕਿ ਪਹਿਲਾਂ ਪਹਿਲ ਉਹ ਹੱਥ ਨਾਲ ਹੀ ਕੱਪੜੇ ਧੋਂਦੀਆਂ ਸਨ ਜਿਸ ਜਿਸ ਕਾਰਨ ਉਹਨਾਂ ਦਾ ਉਹਨਾਂ ਦਾ ਸਮਾਂ ਵੀ ਬਹੁਤ ਬਰਬਾਦ ਹੋ ਜਾਂਦਾ ਸੀ ਅਤੇ ਕਈ ਵਾਰ ਕੱਪੜੇ ਸੁੱਕਦੇ ਵੀ ਨਹੀਂ ਸਨ ਪਰ ਕੱਪੜੇ ਧੋਣ ਵਾਲੀ ਮਸ਼ੀਨ ਜੋ ਕਿ ਬਿਜਲੀ ਨਾਲ ਚੱਲਦੀ ਸੀ ਆਉਣ ਤੋਂ ਬਾਅਦ ਇਸ ਵਿੱਚ ਬਹੁਤ ਹੀ ਤੇਜ਼ੀ ਦੇਖਣ ਨੂੰ ਮਿਲੀ ਹੈ ਕਿ ਅੱਜ ਹਰ ਘਰ ਵਿੱਚ ਇਹ ਮਸ਼ੀਨ ਹੈ ਇਸ ਮਸ਼ੀਨ ਵਿੱਚ ਕੱਪੜੇ ਧੁੱਬ ਵੀ ਜਾਂਦੇ ਹਨ ਅਤੇ ਸੁੱਕ ਵੀ ਜਾਂਦੇ ਹਨ ਇਸ ਲਈ ਔਰਤਾਂ ਦਾ ਧੋਣ ਅਤੇ ਸੁਕਾਉਣ ਦਾ ਝੰਜਟ ਹੀ ਖ਼ਤਮ ਹੋ ਗਿਆ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਤਕਨਾਲੋਜੀ ਨੇ ਜ਼ਿੰਦਗੀ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਹੈ ਅਤੇ ਆਸਾਨ ਬਣਾਉਂਦੀ ਰਹੇਗੀ